ਉਸ ਤਰ੍ਹਾਂ ਤਾਂ ਕੁਦਰਤੀ ਸਰੋਤ ਬਹੁਤ ਸਾਰੇ ਹਨ ਔਰ ਸਾਡੇ ਖੇਤਰਾਂ ਵਿੱਚ ਅਗਰ ਕੁਦਰਤੀ ਸਰੋਤਾਂ ਦੇ ਪ੍ਰਯੋਗ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਖੇਤਰ ਵਿੱਚ ਬਿਆਸ ਦਰਿਆ ਹੈ ਜਿ ਜਿਸ ਦਾ ਪਾਣੀ ਡੈਮ ਦੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ ਜੋ ਬਿਜਲੀ ਸਾਰੇ ਸ਼ਹਿਰ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਇਸ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਸੌਖ ਹੁੰਦੀ ਹੈ ਰਾਤ ਟਾਈਮ ਸਾਡੇ ਘਰਾਂ ਵਿੱਚ ਲਾਈਟ ਹੁੰਦੀ ਹੈ ਗਰਮੀਆਂ ਵਿੱਚ ਅਸੀਂ ਹਵਾ ਲੈ ਸਕਦੇ ਹਾਂ ਔਰ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਮਦਦਗਾਰ ਹੁੰਦੀ ਹੈ ਇਹ ਇੱਕ ਕੁਦਰਤੀ ਸੋਰਸ ਹੈ ਜਿਹਦੇ ਤੋਂ ਸਾਨੂੰ ਇੰਨੀ ਜ਼ਿਆਦਾ ਫੈਸਿਲਿਟੀਜ਼ ਪ੍ਰਾਪਤ ਹੁੰਦੀਆਂ ਹਨ ਔਰ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਤਾਂ ਸਰਕਾਰ ਨੇ ਸੋਲਰ ਪੈਨਲ ਵਰਗੇ ਪ੍ਰਯੋਗ ਵੀ ਮਦਦ ਵਿੱਚ ਲਿਆ ਦਿੱਤੇ ਹਨ ਜਿਹਨਾਂ ਦਾ ਇਸਤੇਮਾਲ ਕਰਕੇ ਅਸੀਂ ਉਹਨਾਂ ਤੋਂ ਸੂਰਜ ਦੀ ਰੋਸ਼ਨੀ ਤੋਂ ਬਿਜਲੀ ਬਣਾ ਸਕਦੇ ਹਾਂ ਉਹ ਸੂਰਜ ਦੀ ਰੋਸ਼ਨੀ ਨਾਲ ਸੋਲਰ ਪੈਨਲ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਅਤੇ ਸਾਡੇ ਸਾਰੇ ਸ਼ਹਿਰ ਨੂੰ ਬਿਜਲੀ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਨਾਲ ਵੀ ਸਾਨੂੰ ਬਹੁਤ ਮਦਦ ਹੁੰਦੀ ਹੈ ਧੰਨਵਾਦ